ਸ਼੍ਰੀ ਫਤਿਹ ਸਾਬ ਫਤਿਹਗੜ੍ਹ ਸਾਹਿਬ ਵਿੱਦਿਅਕ ਅਦਾਰੇ ਬਹੁਤ ਜ਼ਿਆਦਾ ਹਨ ਅਤੇ ਇਹਨਾਂ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕੋਲਜ ਮੁੱਖ ਹਨ ਜਿਨ੍ਹਾਂ ਵਿੱਚ ਬਹੁਤ ਤਰ੍ਹਾਂ ਦੀਆਂ ਬਰਾਂਚਾਂ ਹਨ ਪਰ ਕੰਪਿਊਟਰ ਸਾਇੰਸ ਆ ਕਿ ਜੋ ਉਹ ਸਭ ਤੋਂ ਟੋਪ ਹੈ ਇਸ ਦੇ ਵਿੱਚ ਪੂਰੀ ਐਡਮਿਸ਼ਨ ਹੁੰਦੀ ਹੈ ਅਤੇ ਇਨ੍ਹਾਂ ਦੇ ਵਿੱਚ ਬਹੁਤ ਘੱਟ ਫੀਸਾਂ ਹਨ ਅਤੇ ਹੋਰ ਵੀ ਕੋਲਜ ਹਨ ਜਿਵੇਂ ਮਾਤਾ ਗੁਜਰੀ ਕੋਲਜ ਅਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਲਾਅ ਕੋਲਜ ਹਨ ਅਤੇ ਉਸ ਤੋਂ ਬਾਅਦ ਇਸ ਕੋਲਜਾਂ ਵਿੱਚ ਬਾਹਰੋਂ ਕੰਪਨੀਆਂ ਵੀ ਬੱਚਿਆਂ ਨੂੰ ਜੋਬ ਲਈ ਆਉਂਦੀਆਂ ਹਨ ਅਤੇ ਚੰਗੀਆਂ ਚੰਗੀਆਂ ਲੈਬਾਂ ਹਨ ਅਤੇ ਉਨ੍ਹਾਂ ਵਿੱਚ ਪ੍ਰੈਕਟੀਕਲ ਤਸੱਲੀ ਨਾਲ ਕਰਾਏ ਜਾਂਦੇ ਬੱਚਿਆਂ ਨੂੰ